ਪਹਿਲਾ ਮੁਹਾਵਰਾ ਹੈ ਵੀ ਕਿੱਕਰਾਂ ਨੂੰ ਫ਼ਲ ਲਾਉਣੇ ਮਤਲਬ ਵੀ ਗੱਲਾਂ ਕਹੀ ਜਾਣੀਆਂ ਕਹੀ ਜਾਣੀਆਂ ਕਰਨਾ ਕੁਛ ਹੈ ਨਹੀਂ ਹੈ ਨਾ ਅਤੇ ਦੂਜੀ ਹੁੰਦੀ ਆ ਵੀ ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ ਉਹਦਾ ਮਤਲਬ ਇਹ ਆ ਵੀ ਉਹ ਅੱਜ ਆਇਆ ਅਤੇ ਅੱਜ ਹੀ ਆਪਣੇ ਕਿਸੇ ਚੀਜ਼ ਦਾ ਅੱਧ ਮੰਗਦਾ ਹੋਵੇ ਤਾਂ ਕੁਛ ਵੀ ਕੀਤਾ ਨਾ ਹੋਵੇ ਅਤੇ ਉਹ ਆਪਣੇ ਕੰਮ ਦੇ ਵਿੱਚ ਅੱਧ ਮੰਗਦਾ ਹੋਵੇ ਉਸ ਨੂੰ ਕਹਿੰਦੇ ਨੇ ਵੀ ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ ਅਤੇ ਹੋਰ ਵੀ ਤੀਜੀ ਮੁਹਾਵਰਾ ਸੀਗਾ ਵੀ ਉਸਤਤ ਕੀਤੀ ਨਿੰਦਿਆ ਹੋਏ ਉਸਤਤ ਕੀਤੀ ਨਿੰਦਿਆ ਹੋਏ ਦਾ ਮਤਲਬ ਇਹ ਹੁੰਦਾ ਵੀ ਉਹ ਬੋਲੀ ਜਾਂਦਾ ਨਿੰਦਿਆ ਕਰੀ ਜਾਂਦਾ ਕੋਈ ਗੱਲ ਨਹੀਂ ਕੋਈ ਫਾਇਦਾ ਨਹੀਂ ਉਸ ਚੀਜ਼ ਦਾ